ਹਾਂਜੀ ਮੈਂ ਆਪਣੇ ਸਕੂਲ ਟਾਈਮ 'ਤੇ ਇੱਕ ਕਲਾ ਬਣਾਈ ਸੀ ਅਤੇ ਜਿਹੜੀ ਕਿ ਸਾਨੂੰ ਸਾਡੀ ਡਰੋਇੰਗ ਟੀਚਰ ਨੇ ਬਣਵਾਈ ਸੀ ਸੀਨਰੀ ਸੀ ਅਤੇ ਉਹਦਾ ਮਟੀਰੀਅਲ ਵੀ ਜਿਹੜਾ ਸੀਨਰੀ ਦਾ ਉਹ ਸਾਰਾ ਸਾਡੀ ਡਰੋਇੰਗ ਟੀਚਰ ਨੇ ਲਿਆ ਕੇ ਦਿੱਤਾ ਸੀ ਅਤੇ ਉਹ ਕਾਫ਼ੀ ਅੱਛੀ ਬਣੀ ਸੀ ਅਤੇ ਉਹ ਸਾਡੇ ਘਰ ਦੀ ਦੀਵਾਰ ਵਿੱਚ ਅੱਜ ਵੀ ਲੱਗੀ ਹੋਈ ਹੈ ਅਤੇ ਇਹਦੇ ਪਿੱਛੇ ਮੇਰੀ ਪ੍ਰੇਰਣਾ ਕਿ ਮੈਨੂੰ ਬਚਪਨ ਤੋਂ ਹੀ ਕਾਫੀ ਸ਼ੌਂਕ ਸੀ ਡਰੋਇੰਗ ਕਰਨ ਦਾ ਅਤੇ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਟੀ ਵੀ 'ਤੇ ਵੀ ਆਰਟ ਐਂਡ ਕਰਾਫਟ ਦੇ ਪ੍ਰੋਗਰਾਮ ਜ਼ਿਆਦਾ ਦੇਖਦੀ ਹੁੰਦੀ ਸੀ ਅਤੇ ਮੇਰਾ ਜਿਹੜਾ ਸ਼ੌਂਕ ਸੀ ਕੁਛ ਉੱਥੋਂ ਵੀ ਜਾਗਰੂਕ ਹੋਇਆ ਕਲਾ ਬਣਉਣ ਦਾ ਅਤੇ ਇਹਦੇ ਵਿੱਚ ਜਿਹੜੀਆਂ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਉਂਕਿ ਕਲਾਸ ਵੱਡੀ ਸੀ ਤਾਂ ਮੇਰੀ ਜਿਹੜੇ ਪੇਰੈਂਟਸ ਸੀ ਮੰਮੀ ਪਾਪਾ ਅਤੇ ਉਹ ਵੀ ਚਾਹੁੰਦੇ ਸੀ ਕਿ ਤੂੰ ਆਪਣੀ ਕਲਾ ਨੂੰ ਵੀ ਵਧਾ ਅਤੇ ਪਰ ਇਸ ਦੇ ਨਾਲ ਨਾਲ ਤੇਰਾ ਕੋਈ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਕਿਉਂਕਿ ਕਲਾ ਆਪਣੀ ਜਗ੍ਹਾ ਹੁੰਦੀ ਹੈ ਅਤੇ ਸਟੱਡੀ ਆਪਣੀ ਜਗ੍ਹਾ ਅਤੇ ਉਹ ਸਾਡੀ ਜਿਹੜੀ ਸਟੱਡੀ ਆ ਉਹ ਲਾਈਫ ਟਾਈਮ ਕੰਮ ਆਉਂਦੀ ਆ ਅਤੇ ਮੇਰੇ ਨੰਬਰਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਮੇਰੀ ਜਿਹੜੀ ਸੀ ਉਹ ਬੋਰਡ ਦੀ ਕਲਾਸ ਸੀ ਤਾਂ ਇਸ ਕਰਕੇ ਮੈਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਅਤੇ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ